ਆਰਥਿਕ ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ ਅਸਿੱਧੇ ਢੰਗ ਨਾਲ ਬਦਲਦੀਆਂ ਗਈਆਂ ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਹੋਏ ਇਹਨਾਂ ਤਬਦੀਲੀਆਂ ਨੇ ਨਾ ਸਿਰਫ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਸਗੋਂ ਹੁਣ ਸੁੱਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨੀਆਂ ਨਾਲ ਇਸ ਤਰ੍ਹਾਂ ਜੋੜੇ ਕਿ ਨਾ ਕੇਵਲ ਮਨ ਉੱਤੋਂ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਤਿਹਾਸ ਦੇ ਪੁੱਠੇ ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਲਈ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਸੱਭਿਆਚਾਰ ਰੂਪਾਂਤਰਣ ਇੱਕ ਅਹਿਮ ਅਟੱਲ ਪਰ ਸੂਖਮ ਪਰ ਗੁੰਝਲਦਾਰ ਪ੍ਰਕਿਰਿਆ ਹੈ ਸੱਭਿਆਚਾਰ ਦੇ ਵਿੱਚ ਪਹਿਲਾਂ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਮਨਾਹੀ ਸੀ ਪਰ ਜਿਉਂ ਜਿਉਂ ਸੱਭਿਆਚਾਰ ਬਦਲਦਾ ਗਿਆ ਉਵੇਂ ਉਵੇਂ ਔਰਤਾਂ ਨੂੰ ਖੁੱਲ ਮਿਲਦੀ ਗਈ ਅਤੇ ਆਜ਼ਾਦੀ ਮਿਲਦੀ ਗਈ ਹੁਣ ਔਰਤਾਂ ਘਰੋਂ ਬਾਹਰ ਆਪਣੀ ਮਰਜ਼ੀ ਨਾਲ ਜਾ ਸਕਦੀਆਂ ਹਨ ਅਤੇ ਪੂਰੇ ਹੌਂਸਲੇ ਨਾਲ ਬਾਹਰ ਕਿਤੇ ਵੀ ਘੁੰਮ ਸਕਦੀਆਂ ਹਨ ਪਹਿਲਾਂ ਔਰਤਾਂ ਨੂੰ ਵਿਆਹ ਦੌਰਾਨ ਬਰਾਤ ਵਿੱਚ ਜਾਣ ਦੀ ਵੀ ਆਗਿਆ ਨਹੀਂ ਸੀ ਹੁਣ ਵਿਆਹ ਵਿੱਚ ਵੀ ਜਾਣ ਦੀ ਆਗਿਆ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਹੋਰ ਸੱਭਿਆਚਾਰਕ ਉਪ ਅੰਗ 'ਚ ਪਰਿਵਰਤਨ ਹੁੰਦਾ ਸੱਭਿਆਚਾਰ ਇਕ ਦਮ ਤੱਟ ਫੌਰੀ ਵਰਤਾਰਾ ਨਹੀਂ ਸਗੋਂ ਸੱਭਿਆਚਾਰ ਰੂਪਾਂਤਰਣ ਇੱਕ ਅਤਿਅੰਤ ਪੇਚੀਦਾ ਬਹੁ ਪਰਤੀ ਅਤੇ ਮੱਧਮ ਰਫਤਾਰ ਵਾਪਰਦਾ ਵਰਤਾਰਾ ਸੱਭਿਆਚਾਰ ਪ੍ਰਕਿਰਿਆ ਦਾ ਮੂਲ ਆਧਾਰ ਆਰਥਿਕ ਪ੍ਰਬੰਧ ਅਤੇ ਇਸ ਸਬੰਧ ਵਿੱਚ ਆਏ ਪਰਿਵਰਤਨਾਂ ਅਨੁਕੂਲ ਹੁੰਦਾ ਹੈ ਇਸ ਨਾਲ ਸੱਭਿਆਚਾਰ ਜਿਹੜਾ ਗਤੀਸ਼ੀਲ ਹੁੰਦਾ ਹੈ ਸਮੇਂ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ ਜਿਉਂ ਜਿਉਂ ਸੱਭਿਆਚਾਰ ਵਿਕਸਿਤ ਹੁੰਦਾ ਹੈ ਉਵੇਂ ਉਵੇ ਜੱਗ ਦੀ ਨੂਹਾਰ ਬਦਲਦੀ ਜਾਂਦੀ ਹੈ ਸੱਭਿਆਚਾਰਕ ਆਲੇ ਦੁਆਲੇ ਦੇ ਹਾਵ ਭਾਵ ਦੇਖ ਕੇ ਬਦਲਦਾ ਹੈ ਜਿਉਂ ਜਿਉਂ ਆਲੇ ਦੁਆਲੇ ਹੁੰਦਾ ਹੈ ਉਸੇ ਤਰ੍ਹਾਂ ਸਭਿਅਤਾ ਸੱਭਿਆਚਾਰ ਬਦਲਦਾ ਹੈ